ਮੈਨੂੰ ਤਾਂ ਗੀਤ ਸੁਣਨਾ ਬਹੁਤ ਹੀ ਪਸੰਦ ਹੈ ਮੈਨੂੰ ਤਾਂ ਵੈਸੇ ਦੇਖਿਆ ਜਾਵੇ ਤਾਂ ਮੁਹੰਮਦ ਰਫੀ ਦੇ ਗਾਣੇ ਬਹੁਤ ਪਸੰਦ ਹਨ ਮੈਨੂੰ ਮੁਹੰਮਦ ਰਫੀ ਦੇ ਗਾਣੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਗਾਏ ਹੋਈ ਲੱਗਦੇ ਹਨ ਅਤੇ ਜਿਹੜਾ ਸਥਾਨਕ ਸੰਗੀਤ ਹੈ ਇਹਦੇ ਬਾਰੇ ਅੱਜ ਕੱਲ੍ਹ ਜਿਵੇਂ ਸਤਿੰਦਰ ਸਰਤਾਜ ਦੇ ਗਾਣੇ ਵੀ ਬਹੁਤ ਚੰਗੇ ਲੱਗਦੇ ਹਨ ਜਿਸ ਤਰ੍ਹਾਂ ਸਰਤੀ ਸਤਿੰਦਰ ਸਰਤਾਜ ਨੇ ਗਾਣਾ ਗਾਇਆ ਹੈ ਰੁਤਬਾ ਰੁਤਬਾ ਗਾਣਾ ਉਹਨਾਂ ਦਾ ਬਹੁਤ ਹੀ ਮਸ਼ਹੂਰ ਹੈ ਬੜਾ ਚੰਗਾ ਲੱਗਦਾ ਜਿੰਨੀ ਵਾਰ ਤੁਸੀਂ ਸੁਣਦੇ ਹੋ ਤੁਹਾਡੇ ਮਨ ਨੂੰ ਬੜੀ ਸ਼ਾਂਤੀ ਅਤੇ ਬੜਾ ਹੀ ਅੱਛਾ ਜਿਹਾ ਮਹਿਸੂਸ ਹੁੰਦਾ ਅਤੇ ਜਿੱਥੋਂ ਤੱਕ ਮੁਹੰਮਦ ਰਫੀ ਦੀ ਗਾਣਿਆਂ ਦਾ ਸੰਬੰਧ ਹੈ ਮੈਂ ਤਾਂ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਮੁਹੰਮਦ ਰਫੀ ਦੇ ਗਾਣੇ ਬਹੁਤ ਜ਼ਿਆਦਾ ਸੁਣਦੀ ਹਾਂ ਜਿਸ ਤਰ੍ਹਾਂ ਕਿ ਉਹਨਾਂ ਦਾ ਇੱਕ ਗਾਣਾ ਹੈ ਇੱਕ ਗਾਣਾ ਤਾਂ ਕੀ ਉਹਨਾਂ ਦੇ ਬਹੁਤ ਹੀ ਗਾਣੇ ਹਨ ਜਿਹੜੇ ਕਿ ਮੈਨੂੰ ਬਹੁਤ ਹੀ ਪਸੰਦ ਹਨ ਅਤੇ ਉਹ ਹਿੰਦੀ ਦੇ ਗਾਣੇ ਵੀ ਮੈਂ ਜ਼ਿਆਦਾ ਪਸੰਦ ਕਰਦੀ ਹਾਂ ਪੰਜਾਬੀ ਦੇ ਗਾਣਿਆਂ ਨਾਲੋਂ ਹਿੰਦੀ ਦੇ ਗਾਣੇ ਮੁਹੰਮਦ ਰਫੀ ਦੇ ਕਿਸ਼ੋਰ ਕੁਮਾਰ ਦੇ ਵੀ ਮੈਨੂੰ ਚੰਗੇ ਲੱਗਦੇ ਹੈ